ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਕਿ ਭਾਈਚਾਰਿਆਂ ਖੇਤੀਬਾੜੀ ਉਦਯੋਗ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਜਾ ਸਕਦੇ ਹਨ ਅਤੇ ਜਿਵੇਂ ਕਿ ਆਪਾਂ ਗੱਲ ਕਰਾਂਗੇ ਕਿ ਖੇਤਾਂ ਦੇ ਵਿੱਚ ਕੋਈ ਜਿਹੜੀ ਪਰਾਲੀ ਹੁੰਦੀ ਹੈ ਪਰਾਲੀ ਨੂੰ ਕਦੇ ਵੀ ਅੱਗ ਨਹੀਂ ਲਾਉਣੀ ਚਾਹੀਦੀ ਹਨ ਹੈ ਕਿਉਂਕਿ ਇਹ ਪਰਾਲੀ ਨੂੰ ਅੱਗ ਲਾਉਣ ਕਰਕੇ ਬਹੁਤ ਜਿਹੜਾ ਉਹਦਾ ਧੂੰਆਂ ਪੈਦਾ ਹੁੰਦਾ ਹੈ ਉਹ ਧੂੰਆਂ ਬਹੁਤ ਹੀ ਜ਼ਿਆਦਾ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ ਨਾਲ਼ ਅਤੇ ਦੂਜੇ ਨੰਬਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਜਦੋਂ ਵੀ ਆਪਾਂ ਕੋਈ ਕਣਕ ਬੀਜਦੇ ਹਾਂ ਜਾਂ ਕੋਈ ਵੀ ਕਿਸੇ ਪ੍ਰਕਾਰ ਦਾ ਖੇਤੀ ਖੇਤੀ ਦੇ ਵਿੱਚ ਆਪਾਂ ਕੋਈ ਸਮਾਨ ਬੀਜਦੇ ਹਾਂ ਉੱਥੇ ਕੀਟਨਾਸ਼ਕ ਦਵਾਈਆਂ ਦਾ ਬਹੁਤ ਹੀ ਜ਼ਿਆਦਾ ਘੱਟ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੀਟਨਾਸ਼ਕ ਦਵਾਈਆਂ ਉਹ ਚੀਜ਼ ਹਨ ਜਿਹਨੂੰ ਬੰਦਾ ਛਿੜਕਾਅ ਤਾਂ ਕਰ ਦਿੰਦਾ ਹੈ ਅਤੇ ਬਾਅਦ ਦੇ ਵਿੱਚ ਉਹ ਵੀ ਬਹੁਤ ਹੀ ਜ਼ਿਆਦਾ ਬਿਮਾਰੀਆਂ ਨੂੰ ਨਿਓਤਾ ਦਿੰਦਾ ਹੈ ਜਿਸ ਦੇ ਕਾਰਨ ਆਪਾਂ ਨੂੰ ਕਈ ਪ੍ਰਕਾਰ ਦੀਆਂ ਇਨਸਾਨ ਨੂੰ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਜਿਹੜੀ ਪਰਾਲੀ ਹੁੰਦੀ ਹੈ ਨਾ ਪਰਾਲੀ ਨੂੰ ਅੱਗ ਲਾਉਣੀ ਚਾਹੀਦੀ ਹੈ ਅਤੇ ਨਾ ਕੀਟਨਾਸ਼ਕ ਦਵਾਈਆਂ ਦਾ ਬਹੁਤ ਹੀ ਘੱਟ ਤੋਂ ਘੱਟ ਪ੍ਰਯੋਗ ਕਰਨਾ ਚਾਹੀਦਾ ਹੈ